ਸਤਿ ਸ਼੍ਰੀ ਅਕਾਲ ਜੀ ਤੁਸੀਂ ਪੁੱਛਿਆ ਕਿਹੜੀਆਂ ਚੀਜ਼ਾਂ ਸਭ ਤੋਂ ਵੱਧ ਬੁਣੀਆਂ ਜਾਂ ਸਿਲਾਈ ਕਰਦੀਆਂ ਹਨ ਇਹ ਕਿਸ ਕਿਸਮ ਦੇ ਕੱਪੜੇ ਬਣਾਉਣਾ ਪਸੰਦ ਕਰਦੇ ਹਾਂ ਅਸੀਂ ਮੈਂ ਸਿਲਾਈ ਦਾ ਕੰਮ ਬਹੁਤ ਵਧੀਆ ਕਰ ਲੈਂਦੀ ਹਾਂ ਅਤੇ ਉਹ ਹੀ ਮੈਨੂੰ ਬਹੁਤ ਪਸੰਦ ਹੈ ਇਸ ਕਰਕੇ ਮੈਂ ਉਹ ਹੀ ਜ਼ਿਆਦਾ ਕੰਮ ਕੀਤਾ ਹੈ ਅਤੇ ਇਸ ਕਰਕੇ ਮੈਂ ਸਿਲਾਈ ਕਰਨ ਵਿੱਚ ਮੈਨੂੰ ਸੂਟ ਸੀਣਾ ਸਭ ਤੋਂ ਜ਼ਿਆਦਾ ਪਸੰਦ ਹੈ ਅਤੇ ਮੈਂ ਇਸ ਕਰਕੇ ਸੂਟ ਦੀ ਸਿਲਾਈ ਕਰਨੀ ਬਹੁਤ ਵਧੀਆ ਮੈਨੂੰ ਬਹੁਤ ਪਸੰਦ ਹੈ ਇਸ ਕਰਕੇ ਮੈਂ ਸੂਟ ਸਿਲਾਈ ਕਰਦੀ ਹਾਂ ਅਤੇ ਉਹਨਾਂ ਨੂੰ ਤੇਜ਼ੀ ਨਾਲ ਅਤੇ ਬੇਹਤਰ ਕਰਨ ਲਈ ਮੈਂ ਸਿਲਾਈ ਮਸ਼ੀਨ ਅੱਜ ਕੱਲ੍ਹ ਦੀ ਨਵੀਂ ਨਵੇਂ ਜ਼ਮਾਨੇ ਦੀ ਨਵੀਂ ਤਕਨੀਕ ਵਾਲੀ ਸਲਾਈ ਮਸ਼ੀਨ ਯੂਜ ਕਰਦੀ ਹਾਂ ਕਿ ਉਹਦੇ ਨਾਲ ਕੰਮ ਸੌਖਾ ਹੋ ਜਾਂਦਾ ਹੈ ਅਤੇ ਜਲਦੀ ਹੋ ਜਾਂਦਾ ਹੈ ਇਸ ਕਰਕੇ ਮੈਂ ਸਿਲਾਈ ਬਹੁਤ ਵਧੀਆ ਢੰਗ ਨਾਲ ਅਤੇ ਬਹੁਤ ਹੀ ਮਨ ਲਾ ਕੇ ਕਰਦੀ ਹਾਂ ਅਤੇ ਇੱਦਾਂ ਮੇਰਾ ਮੇਰਾ ਸ਼ੌਂਕ ਵੀ ਸੀ ਸਿਲਾਈ ਕਰਨ ਦਾ ਉਹ ਵੀ ਮੇਰਾ ਪੂਰਾ ਹੋ ਗਿਆ ਸ਼ੌਂਕ ਦੇ ਨਾਲ ਕੋਈ ਵੀ ਕੰਮ ਕਰੀਏ ਤਾਂ ਵਧੀਆ ਢੰਗ ਨਾਲ ਕਰ ਸਕਦੇ ਆਪਾਂ ਦਿਲ ਲਾ ਕੇ ਜਿਸ ਚੀਜ਼ 'ਚ ਦਿਲ ਹੋਵੇ ਉਹ ਹੀ ਕੰਮ ਕਰਨਾ ਚਾਹੀਦਾ ਇਸ ਕਰਕੇ ਮੈਂ ਉਹ ਹੀ ਕੰਮ ਕਰਦੀ ਹਾਂ ਜਿਹੜਾ ਮੈਨੂੰ ਪਸੰਦ ਸੀ ਮੈਨੂੰ ਸਿਲਾਈ ਬਹੁਤ ਪਸੰਦ ਸੀ ਮੈਂ ਸਿਲਾਈ ਦਾ ਕੰਮ ਕਰਦੀ ਹਾਂ ਅਤੇ ਮੈਂ ਸਿਲਾਈ ਬਹੁਤ ਵਧੀਆ ਢੰਗ ਨਾਲ ਕਰਦੀ ਹਾਂ ਕਿਉਂਕਿ ਮੇਰਾ ਮਨ ਸੀ ਉਸੇ ਚੀਜ਼ ਵਿੱਚ ਸੀ ਬਾਕੀ ਮੈਂ ਨਵੀਂ ਤਕਨੀਕ ਦੇ ਨਾਲ ਹਰ ਤਰ੍ਹਾਂ ਦੇ ਕੱਪੜੇ ਬਣਾ ਲੈਂਦੀ ਹਾਂ ਅਤੇ ਮੈਨੂੰ ਇਹ ਚੀਜ਼ ਕੰਮ ਕਰਨਾ ਪਸੰਦ ਵੀ ਹੈ ਇਸ ਕਰਕੇ ਮੈਂ ਸਿਲਾਈ ਕਰਨਾ ਬਹੁਤ ਪਸੰਦ ਕਰਦੀ ਹਾਂ ਅਤੇ ਇਸ ਕਰਕੇ ਮੈਂ ਆਪਣੇ ਬੱਚਿਆਂ ਨੂੰ ਵੀ ਇਹੋ ਸ਼ਿਕਸ਼ਾ ਦਿੰਦੀ ਹਾਂ ਕਿ ਆਪਣਾ ਕੰਮ ਆਪਣੇ ਹੱਥਾਂ ਨਾਲ ਸਿਲਾਈ ਕਰਨਾ ਸਿੱਖੋ ਅਤੇ ਇਹ ਬਹੁਤ ਵਧੀਆ ਲੱਗਦਾ ਹੈ ਬਹੁਤ ਹੀ ਵਧੀਆ ਕੰਮ ਹੈ ਅਤੇ ਆਪਣੇ ਹੱਥਾਂ ਨਾਲ ਇਹ ਕੰਮ ਕਰਕੇ ਮੈਨੂੰ ਬਹੁਤ ਸਕੂਨ ਮਿਲਦਾ ਥੈਂਕ ਯੂ